ਹਾਂਜੀ ਨਮਸਤੇ ਸਰ ਸਰ ਤੁਸੀਂ ਰੈਸਟੋਰੈਂਟ ਤੋਂ ਗੱਲ ਕਰਦੇ ਹੋ ਹਾਂਜੀ ਸਰ ਅਸੀਂ ਕੁਝ ਖਾਣ ਪੀਣ ਦਾ ਸਮਾਨ ਤੁਹਾਡੇ ਰੈਸਟੋਰੈਂਟ ਤੋਂ ਔਡਰ ਕਰਨਾ ਚਾਹੁੰਦੇ ਹਾਂ ਪਰ ਅਸੀਂ ਇਹ ਪਤਾ ਲਗਾਉਣਾ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਤ ਦਾ ਸਮਾਂ ਹੈ ਅਤੇ ਬਾਹਰ ਬਹੁਤ ਹੀ ਭਾਰੀ ਮੀਂਹ ਵੀ ਪੈ ਰਿਹਾ ਹੈ ਅਤੇ ਸਾਡਾ ਘਰ ਤੁਹਾਡੇ ਰੈਸਟੋਰੈਂਟ ਤੋਂ ਬਹੁਤ ਹੀ ਦੂਰ ਹੈ ਤਾਂ ਸਰ ਅਸੀਂ ਇਹ ਪਤਾ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇਹ ਸਭ ਦੇਖਦੇ ਹੋਏ ਸਾਡੇ ਘਰ ਤੱਕ ਖਾਣਾ ਪਹੁੰਚਾ ਸਕਦੇ ਹੋ ਜਾਂ ਨਹੀਂ